ਬਾਗਵਾਨੀ ਸ਼ੁਰੂ ਜੇਕਰ ਬਾਗਵਾਨੀ ਦੀ ਗੱਲ ਕਰਾਂ ਤਾਂ ਮੈਂ ਬਾਗਵਾਨੀ ਜਦੋਂ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਆਈ ਹਰਿਆਲੀ ਐਪ ਲਾਂਚ ਕੀਤੀ ਜਿਸ ਨਾਲ ਮੁਫ਼ਤ ਵਿੱਚ ਬੂਟੇ ਦਿੱਤੇ ਵੰਡੇ ਮੈਂ ਕੁਝ ਫ਼ਲਦਾਰ ਬੂਟੇ ਲਿਆ ਕੇ ਘਰ ਲਾਏ ਜਦੋਂ ਉਹ ਬਲ ਫਲਦਾਰ ਬੂਟੇ ਕਾਮਯਾਬ ਹੋ ਗਏ ਤਾਂ ਮੈਨੂੰ ਇਹਨਾਂ ਦੀ ਚੇਟਕ ਲੱਗ ਗਈ ਫਿਰ ਮੈਂ ਕੁਝ ਹੋਰ ਆਪ ਮੁੱਲ ਲਿਆ ਕੇ ਬੂਟੇ ਲਾਏ ਜਿਵੇਂ ਕੀਨੂੰ ਸੰਤਰਾ ਨਾਸਪਤੀ ਆਲੂ ਬੁਖ਼ਾਰਾ ਇਹ ਸਾਰੇ ਬੂਟੇ ਮੈਂ ਖੇਤ ਵਿੱਚ ਲਾਏ ਇਹ ਸਾਰੇ ਇੱਕ ਇੱਕ ਦੋ ਦੋ ਨਗ ਕਾਮਯਾਬ ਹੋਏ ਜਿਸ ਨਾਲ ਮੈਂ ਬਾਗਵਾਨੀ ਜਿਹੜੀ ਸ਼ੁਰੂ ਕੀਤੀ ਅਤੇ ਇਹ ਫਲਦਾਰ ਬੂਟੇ ਹਰ ਰੁੱਤ ਵਿੱਚ ਭਾਵ ਸੀਜਨ 'ਚ ਫ਼ਲ ਦਿੰਦੇ ਆ ਜਿਸ ਨਾਲ ਬਹੁਤ ਫ਼ਾਇਦਾ ਹੁੰਦਾ ਆਮ ਗੱਲ ਕਰਾਂ ਕਿ ਆਮ ਘਰ ਆਪਾਂ ਜਦੋਂ ਫ਼ਲ ਲਿਆਉਦੇ ਹਾਂ ਫ਼ਲ ਮਹਿੰਗੇ ਹੁੰਦੇ ਹੈ ਲਿਆ ਕੇ ਆਪਾਂ ਨਹੀਂ ਖਾ ਸਕਦੇ ਪਰ ਬਾਗਵਾਨੀ ਜਾਂ ਕਹਿ ਲਓ ਫ਼ਲਾਂ ਦੇ ਬੂਟਿਆਂ ਲਾਉਣ ਨਾਲ ਇਹ ਜਿਹੜੇ ਫ਼ਲ ਹੈ ਹੁਣ ਘਰ ਵਿੱਚ ਆਮ ਵੀ ਰਹਿੰਦੇ ਆ ਇਹ ਅਸੀਂ ਵੀ ਖਾਂਦੇ ਹਾਂ ਨਾਲ ਨਾਲ ਸਾਡੇ ਸਕੇ ਸਬੰਧੀ ਰਿਸ਼ਤੇਦਾਰਾਂ ਨੂੰ ਵੀ ਫ਼ਲ ਦੇ ਦਿੰਦੇ ਹੈ